ਭੰਗੜੇ ਵਾਲਿਆਂ ਦਾ ਪਹਿਰਾਵਾ ਜਿਹੜਾ ਹੁੰਦਾ ਉਹ ਬਹੁਤ ਹੀ ਵਧੀਆ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਕੁੜਤਾ ਚਾਦਰਾ ਆਦਿ ਪਾਇਆ ਹੁੰਦਾ ਹੈ ਅਤੇ ਕੁੜੀਆਂ ਨੇ ਪੰਜਾਬੀ ਸੂਟ ਆਦਿ ਪਾਏ ਹੁੰਦੇ ਸਨ ਜਿਹਨਾਂ ਨੇ ਪੰਜਾਬੀ ਪ੍ਰਾਂਦਾ ਸੱਗੀ ਫੁੱਲ ਆਦਿ ਜਿਸ ਤਰ੍ਹਾਂ ਸਿਰ 'ਤੇ ਸਜਾਏ ਹੁੰਦੇ ਸਨ ਜਿਹਦੇ ਨਾਲ ਪੱਗ ਮੁੰਡੇ ਦੇ ਪੱਗ 'ਤੇ ਦਮਾਲੇ ਕੱਢੇ ਹੁੰਦੇ ਸਨ ਜਿਹਦੇ ਨਾਲ ਉਹ ਬਹੁਤ ਹੀ ਵਧੀਆ ਲੱਗਦੇ ਸਨ ਅਤੇ ਲੋਕ ਵੀ ਉਹਨਾਂ ਨੂੰ ਦੇਖ ਕੇ ਐਂ ਕਰਦੇ ਸਨ ਕਿ ਜਿਹੜੀ ਸਾਨੂੰ ਅਸੀਂ ਵੀ ਇਹਨਾਂ ਨੂੰ ਦੇਖ ਕੇ ਮਤਲਬ ਵਧੀਆ ਭੰਗੜੇ ਵਿੱਚ ਪਾਰਟੀਸਪੇਟ ਕਰੀਏ ਅਤੇ ਜਿੱਤ ਕੇ ਆਪਦਾ ਵਧੀਆ ਫਿਊਚਰ ਬਣਾਈਏ ਉਹਨਾਂ ਦਾ ਜਿਹੜਾ ਡਾਂਸ ਵਾਲੇ ਜਿਹੜੇ ਹੁੰਦੇ ਸਨ ਉਹਨਾਂ ਦਾ ਜਿਹੜਾ ਭੰਗੜਾ ਹੈ ਉਹ ਆਪਣੀ ਕਾਸ਼ਟ ਕਰਦੇ ਸਨ ਉਹਨਾਂ ਦਾ ਪੰਜਾਬੀ ਭੰਗੜਾ ਇੱਕ ਬਹੁਤ ਹੀ ਵਧੀਆ ਤਰੀਕੇ ਦਾ ਹੁੰਦਾ ਹੈ ਜਿਹਦੇ ਨਾਲ ਉਹਨਾਂ ਦੇ ਕੱਪੜੇ ਬਹੁਤ ਹੀ ਚਮਕ ਦਮਕ ਵਾਲੇ ਹੁੰਦੇ ਸਨ ਕੁੜਤਾ ਚਾਦਰਾ ਆਦਿ ਹੁੰਦੇ ਸਨ ਜਿਹਦੇ ਵਿੱਚ ਉਹਨਾਂ ਦੀਆਂ ਬਹੁਤ ਹੀ ਵਧੀਆ ਭੰਗੜੇ ਦੇ ਸਟੈਪ ਕੀਤੇ ਜਾਂਦੇ ਸਨ ਉਹਨਾਂ ਦੇ ਸੱਭਿਆਚਾਰਕ ਆਦਿ ਦੇ ਨਾਲ ਰਿਲੇਟਡ ਹੁੰਦੇ ਸਨ ਜਿਵੇਂ ਕਿ ਪੰਜਾਬੀ ਵਿੱਚ ਪੰਜਾਬੀ ਪਹਿਰਾਵਾਂ ਹੁੰਦਾ ਇਸੇ ਲਈ ਹਰਿਆਣੇ ਵਿੱਚ ਹਰਿਆਣਵੀ ਪਹਿਰਾਵਾ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਲਹਿੰਗਾ ਚੋਲੀ ਪਾਇਆ ਜਾਂਦਾ ਹੈ ਅਤੇ ਉਸ ਨੂੰ ਹਰਿਆਣੇ ਵਿੱਚ ਹਰਿਆਣਵੀ ਕਹਿੰਦੇ ਸਨ ਹਰ ਇੱਕ ਕੰਟਰੀ ਦਾ ਆਪਦਾ ਆਪਦਾ ਪਹ ਪਹਿਰਾਵਾ ਹੁੰਦਾ ਹੈ ਲੇਕਿਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦਾ ਡਾਂਸ ਹੁੰਦਾ ਹੈ ਉਹ ਬਹੁਤ ਹੀ ਗਲਤ ਤਰੀਕੇ ਦਾ ਕੀਤਾ ਜਾਂਦਾ ਜਿਹਦੇ ਵਿੱਚ ਇਹ ਬਹੁਤ ਹੀ ਬਹੁਤ ਹੀ ਗਲਤ ਵਿਵਹਾਰ ਸਮਾਜ ਵਿੱਚ ਕੀਤਾ ਜਾ ਰਿਹਾ ਹੈ ਇਹ ਗਲਤ ਨਹੀਂ ਹੋਣਾ ਚਾਹੀਦਾ ਇਹਦਾ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੋਣਾ ਚਾਹੀਦਾ ਹੈ ਜਿਹੜਾ ਕਿ ਪੰਜਾਬੀ ਪਹਿਰਾਵੇ ਨੂੰ ਆਦਿ ਕਾਇਮ ਰੱਖੇ ਅਤੇ ਪੰਜਾਬੀ ਪੰਜਾਬੀ ਸਭਿਅਤਾ ਦੇ ਨਾਲ ਜੋੜੀ ਰੱਖੇ